ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਠੀਕ ਐ ਅੱਛਾ ਜੀ ਹੂੰ ਤੇ ਕਿਹੜਾ ਕਿਹੜਾ ਮੋਡਲ ਐ ਅਠਾਰਾਂ ਮੋਡਲ ਨਹੀਂ ਏ ਸੀ ਅੱਛਾ ਬੰਦ ਹੋ ਗਿਆ ਜਮਾਂ ਈ ਕੂਲਿੰਗ ਨਹੀਂ ਦੇ ਰਿਹਾ ਜੀ ਉਹ ਫੇਰ ਨਾ ਜਾਂ ਤਾਂ ਕੋਈ ਪਾਈਪ 'ਚ ਲੀਕੇਜ ਲੂਕੇਜ ਨਾ ਹੋ ਗਈ ਹੋਵੇ ਕੋਈ ਜਦੋਂ ਆਪਾਂ ਗੈਸ ਵਗੈਰਾ ਜਿਹੜੀ ਹੁੰਦੀ ਐ ਅੱਛਾ ਜੀ ਗੈਸ ਪਾਈ ਸੀ ਹੂੰ ਤੇ ਹਾਂਜੀ ਅੱਛਾ ਜੀ ਤੇ ਉਹ ਤਾਂ ਕੋਈ ਨੀ ਤੁਸੀਂ ਫੇਰ ਗੱਡੀ ਜਾਂ ਤਾਂ ਲੈ ਆਓ ਤੇ ਫੇਰ ਆਪਾਂ ਕਰ ਦਿੰਨੇ ਉਨ੍ਹਾਂ ਦਾ ਅਲਾਈਨਮੈਂਟ ਸੈੱਟ ਸਭ ਕੁਛ ਕਰ ਦਾਂਗੇ ਜਿਹੜਾ ਹੋਰ ਵੀ ਕੋਈ ਪ੍ਰੋਬਲਮ ਐ ਤਾਂ ਆਪਾਂ ਉਹ ਵੀ ਦੇਖ ਲਾਂਗੇ ਚਾਰਜ ਤਾਂ ਏਹੀ ਐ ਜੀ ਆਪਣੀ ਚਲੋ ਤੁਸੀਂ ਪਹਿਲਾਂ ਵੀ ਕੰਮ ਕਰਾਂਦੇ ਰਹਿੰਦੇ ਆਪਣੇ ਘਰ ਦੀ ਗੱਲ ਐ ਆਪਾਂ ਤਾਂ ਅੱਗੇ ਵੀ ਤੁਹਾਡੇ ਤੋਂ ਨਾ ਵੱਧ ਲਿਆ ਤੇ ਨਾ ਈ ਹੁਣ ਲੈਣਾ ਬਾਕੀ ਜੋ ਮੌਕੇ ਤੇ ਜੇ ਸਾਰਾ ਮਤਲਬ ਸਰਵਿਸ ਵਗੈਰਾ ਤਾਂ ਤਾਂ ਆਪਾਂ ਓਥੇ ਦੇਖਾਂਗੇ ਨਾ ਵੀ ਹੋਰ ਵੀ ਕੀ ਜੇ ਕੋਈ ਹੋਰ ਪਾਰਟ ਵਗੈਰਾ ਖਰਾਬ ਹੋਇਆ ਤਾਂ ਇਹ ਵੀ ਦੇਖਲਾਂਗੇ ਫੇਰ ਚੇਂਜ ਕਰ ਦਿਆਂਗੇ ਜੀ ਹਾਂਜੀ ਐਹੀ ਜੀ ਕੋਈ ਪੈਸਿਆਂ ਦੀ ਕੋਈ ਗੱਲ ਨੀ ਹੈ ਨੀ ਜੀ ਆਪਾਂ ਜੈਜ ਰੇਟ ਈ ਜੋ ਠੀਕ ਐ ਜੀ ਅੱਛਾ ਕੋਈ ਨੀ ਤੁਸੀਂ ਫੇਰ ਐਅ ਕਰੋ ਅੱਜ ਈ ਮੈਨੂੰ ਜਾਂ ਤਾਂ ਸ਼ਾਮ ਨੂੰ ਭੇਜ ਦੋ ਉਹ ਅੱਛਾ ਜੋ ਫੇਰ ਕਿੱਟ ਉਹ ਗੇਰ ਦੀ ਜਿਹੜੀ ਕਿੱਟ ਹੁੰਦੀ ਉਹ ਵੀ ਚੇਂਜ ਕਰ ਦਿਆਂਗੇ ਜਾਂ ਤਾਂ ਕਿਉਂਕੀ ਉਹਦੇ 'ਚ ਜੇ ਪ੍ਰੋਬਲਮ ਹੋਈ ਤਾਂ ਉਹ ਕਿੱਟ ਈ ਸਾਰੀ ਬਦਲਣੀ ਪੈਣੀ ਐ ਨਾਂ ਹਾਂਜੀ ਹਾਂਜੀ ਪਤਾ ਕੀ ਐ ਜੀ ਇਹ ਹੁਣ ਪੁਰਾਣੇ ਟੈਰ ਦੇਖਣੇ ਪੈਣੇ ਵੈਸੇ ਕੋਈ ਕੰਮ ਵੀ ਕਿਸੇ ਦੇ ਆ ਜਾਣ ਬਾਕੀ ਵੈਸੇ ਹੁੰਦੇ ਤਾਂ ਨਈਂ ਅੱਛਾ ਉਹ ਤਾਂ ਫੇਰ ਦੇਖ ਲਾਂਗੇ ਜੇ ਕਿਤੇ ਹੋਰ ਦੇ ਕੰਮ ਆ ਗਏ ਤਾਂ ਫੇਰ ਆਪਾਂ ਬਦਲ ਦਿਆਂਗੇ ਫੇਰ ਤੁਹਨੂੰ ਸਾਰੇ ਚੇਂਜ ਕਰ ਦਿਆਂਗੇ ਨਵਾਂ ਬਾਕੀ ਜੇ ਚਾਰੇ ਟੈਰ ਦੇਖੀਏ ਤਾਂ ਵੀਹ ਹਜਾਰ ਖਰਚਾ ਚਾਰੇ ਦਾ ਉਹ ਫੇਰ ਪੰਜ ਹਜਾਰ ਹੋਰ ਡਿਸਕਾਊਂਟ ਲਾ ਲੋ ਹੋਰ ਪੰਦਰਾਂ ਹਜਾਰ ਤੱਕ ਐੱਮ ਆਰ ਐੱਫ ਦੇ ਟਾਇਰ ਪਾ ਦਿਆਂਗੇ ਜੀ ਨਹੀਂ ਉਸ ਨਾਲੋਂ ਤਾਂ ਐੱਮ ਆਰ ਐੱਫ ਪਾਉਣਾ ਸਹੀ ਐ ਨਾ ਉਹ ਥੋੜੇ ਸਸਤੇ ਐ ਫੇਰ ਵੀ ਚਲ ਆਪਾਂ ਆਹ ਮਹਿੰਗੇ ਈ ਪਾ ਦੇ ਆਂ ਇਨ ਦੀ ਦੋ ਸਾਲ ਦੀ ਐ ਜੀ

ਓਕੇ ਓਕੇ ਓਕੇ ਜੀ ਚਲੋ ਕੋਈ ਨਾ ਤੁਸੀਂ ਮੈਨੂੰ ਸ਼ਾਮ ਤੱਕ ਭੇਜ ਦਿਓ ਓਕੇ